ਖਾਣਾ ਬਣਾਉਣ ਵੇਲੇ ਕੜਾਹੀ ਅਤੇ ਕੜਛੀ ਦੀ ਵਰਤੋਂ ਕੀਤੀ ਜਾਂਦੀ ਹੈ ਕੜਾਹੀ ਵਿੱਚ ਸਬਜ਼ੀ ਬਣਾਈ ਜਾਂਦੀ ਹੈ ਅਤੇ ਕੜਛੀ ਨਾਲ ਉਸ ਸਬਜ਼ੀ ਨੂੰ ਹਿਲਾ ਹਿਲਾਇਆ ਜਾਂਦਾ ਹੈ ਬਣਾਇਆ ਜਾਂਦਾ ਹੈ ਅਤੇ ਇੱਕ ਪਰਾਤ ਵਿੱਚ ਆਟਾ ਗੁੰਨਿਆ ਜਾਂਦਾ ਹੈ ਅਤੇ ਇੱਕ ਤਵੇ ਨੂੰ ਗਰਮ ਕਰਕੇ ਉਸ 'ਤੇ ਵੇਲੀ ਹੋਈ ਰੋਟੀ ਰੱਖੀ ਜਾਂਦੀ ਹੈ ਜੋ ਕਿ ਪੱਕ ਕੇ ਰੋਟੀ ਖਾਣ ਯੋਗ ਬਣ ਜਾਂਦੀ ਹੈ ਅਤੇ ਚੱਕਲੇ ਵੇਲਣੇ ਦੀ ਵਰਤੋਂ ਅਸੀਂ ਗੋਟ ਰੋਟੀ ਨੂੰ ਬਣਾਉਣ ਲਈ ਕਰਦੇ ਹਾਂ ਰੋਟੀ ਦਾ ਪੇੜਾ ਕਰਕੇ ਆਪਾਂ ਉਸਨੂੰ ਚੱਕਲੇ 'ਤੇ ਰੱਖਦੇ ਹਾਂ ਅਤੇ ਵੇਲਣੇ ਨਾਲ ਰੋਟੀ ਵੇਲ ਕੇ ਆਪਾਂ ਤਵੇ 'ਤੇ ਰੱਖਦੇ ਹਾਂ ਕੌਲੀਆਂ ਦੀ ਵਰਤੋਂ ਆਪਾਂ ਕੋਈ ਵੀ ਖਾਣਾ ਜਮੀ ਜਿਵੇਂ ਸਬਜ਼ੀ ਪਾ ਕੇ ਖਾਈ ਜਾਂਦੀ ਹੈ ਚਮਚੇ ਨਾਲ ਉਹ ਸਬਜ਼ੀ ਖਾਂਦੇ ਹਾਂ ਅਤੇ ਉਹ ਉਹ ਸਬਜ਼ੀ ਖਾ ਕੇ ਸਾਰੇ ਸਬਜ਼ੀ ਬਣਾ ਕੇ ਆਪਾਂ ਉਹਨਾਂ ਬਰਤਨਾਂ ਨੂੰ ਧੋ ਦਿੰਦੇ ਹਾਂ ਮਾਂਜ ਦਿੰਦੇ ਹਾਂ